ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਘਰ ਵਿੱਚ ਸੁਸ਼ ਸ਼ੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ ਹਰ ਘਰ ਵਿੱਚ ਇੱਕ ਹਰ ਇੱਕ ਮੈਂਬ ਹਰ ਇੱਕ ਮੈਂਬਰ ਕੋਲ ਮੋਬਾਈਲ ਹੁੰਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਵਿਅਕਤੀ ਸ਼ੋਸ਼ਲ ਮੀਡੀਆ ਨਾਲ ਜੁੜਿਆ ਹੈ ਜਿਵੇਂ ਆਪਾਂ ਡਾਂਸ ਦੀ ਗੱਲ ਕਰ ਰਹੇ ਹਾਂ ਓਨਲਾਈਨ ਕਲਾਸਾਂ ਨਾਲ ਬੱਚਿਆਂ ਦਾ ਸਮਾਂ ਬਚਦਾ ਹੈ ਕਿਉਂਕਿ ਕਈ ਵਾਰ ਰਸਤਾ ਲੰਬਾ ਕਾਫੀ ਲੰਬਾ ਹੁੰਦਾ ਹੈ ਕਈ ਵਾਰ ਘਰ ਦੇ ਹਾਲਾਤ ਐਸੇ ਅਜਿਹੇ ਹੁੰਦੇ ਹਨ ਬੱਚਾ ਡਾਂਸ ਨਹੀਂ ਡਾਂਸ ਕਲਾਸ ਨਹੀਂ ਲਗਾ ਸਕਦਾ ਪਰ ਓਨਲਾਈਨ ਕਲਾਸਾਂ ਰਾਹੀਂ ਬੱਚੇ ਆਪਣਾ ਸ਼ੌਕ ਪੂਰਾ ਕਰ ਸਕਦੇ ਹਨ ਅੱਜ ਕੱਲ੍ਹ ਇਸਟਾਗ੍ਰਾਮ ਫੇਸਬੁੱਕ ਅਤੇ ਯੂਟਿਊਬ 'ਤੇ ਬਹੁਤ ਚੈਨਲ ਹਨ ਜਿਹਨਾਂ ਰਾਹੀਂ ਬੱਚੇ ਘਰ ਬੈਠੇ ਬੈਠੇ ਡਾਂਸ ਸਿੱਖ ਲੈਂਦੇ ਆ ਅੱਜ ਕੱਲ੍ਹ ਜਵਾਕ ਇੰਸਟਾਗਰਾਮ 'ਤੇ ਰੀਲਾਂ ਵੀ ਬਹੁਤ ਦੇਖਦੇ ਆ ਉਸ ਦੀ ਮਦਦ ਨਾਲ ਬੱਚੇ ਡਾਂਸ ਸਿੱਖ ਲੈਂਦੇ ਹਨ ਅਤੇ ਰੀਲਾਂ ਵੀ ਬਣਾ ਲੈਂਦੇ ਹਨ ਇਸ ਤਰ੍ਹਾਂ ਸਾਨੂੰ ਹਰੇਕ ਘਰ ਵਿੱਚ ਲੈਪਟਾਪ ਹੁੰਦਾ ਹੈ ਲੈਪਟਾਪ ਦੀ ਮਦਦ ਨਾਲ ਵੀ ਬੱਚੇ ਬਹੁਤ ਜ਼ਿਆਦਾ ਸਿੱਖਦੇ ਹਨ